ਮੇਰਾ ਸ਼ਹਿਰ ਰੋਪੜ ਪਹਿਲੀ ਗੱਲ ਤਾਂ ਗੁਰਦੁਆਰਿਆਂ ਦੇ ਲਈ ਮਸ਼ਹੂਰ ਸੀ ਇਹ ਇੱਕ ਇਤਿਹਾਸਿਕ ਜਗ੍ਹਾ ਹੈ ਜਿੱਥੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਨੇ ਜਿਵੇਂ ਕਿ ਭੱਠਾ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਟਿੱਬੀ ਸਾਹਿਬ ਇੱਥੇ ਗੁਰੂ ਗੋਬਿੰਦ ਸਿੰਘ ਜੀ ਕਾਫੀ ਵਾਰੀ ਆਏ ਨੇ ਅਤੇ ਇਹ ਗੁਰਦੁਆਰਿਆਂ ਸਾਹਿਬ ਇਹ ਗੁਰਦੁਆਰੇ ਬਹੁਤ ਹੀ ਪ੍ਰਚੱਲਿਤ ਨੇ ਕਿ ਇਹ ਗੁਰੂਆਂ ਦੀ ਧਰਤੀ ਮੰਨਿਆਂ ਜਾਂਦਾ ਏ ਰੋਪੜ ਨੂੰ ਅਤੇ ਜਿਹੜੀ ਇੱਕ ਰੋਪੜ ਦੀ ਮਸ਼ਹੂਰ ਜਗ੍ਹਾ ਏ ਜਿਹਨੂੰ ਕਿ ਹੜੱਪਾ ਸੱਭਿਅਤਾ ਜਿਹਨੂੰ ਕਿ ਅੰਗਰੇਜ਼ੀ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਕਿਹਾ ਜਾਂਦਾ ਏ ਜਿਹੜੀ ਕਿ ਇਸ ਸਮਾਜ ਦੀ ਸਾਰਿਆਂ ਨਾਲੋਂ ਪੁਰਾਣੀ ਸੱਭਿਅਤਾ ਏ ਜਿਹਨੂੰ ਲੋਕ ਕਾਫੀ ਲੋਕ ਦੂਰੋਂ ਵੇਖਣ ਲਈ ਆਉਂਦੇ ਹਨ ਅਤੇ ਇਹਨਾਂ ਨੂੰ ਕੁਝ ਕੁ ਲੋਕਾਂ ਨੂੰ ਹੀ ਇਸ ਸੱਭਿਅਤਾ ਬਾਰੇ ਪਤਾ ਏ ਅਤੇ ਲੋਕ ਕਾਫੀ ਲੋੋਕ ਇਨ ਇਸ ਸੱਭਿਅਤਾ ਨੂੰ ਦੂਰੋਂ ਦੂਰੋਂ ਵੇਖਣ ਲਈ ਆਉਂਦੇ ਹਨ